ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਪ੍ਰਦੂਸ਼ਣ ਸਾਡੇ ਸਿਹਤ ਦੇ ਮਾੜਾ ਅਸਰ ਕਰ ਰਿਹਾ ਹੈ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ ਹੈ ਇੰਡੀਆ 'ਚ ਇਸ ਤੋਂ ਇਹਨੂੰ ਘਟਾਉਣ ਦੀ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਹੈ ਗਲੀ ਗੁਆਂਢ 'ਚ ਕੂਰਾ ਕੂੜਾ ਕਰਕਟ ਗਲੀ ਮੁਹੱਲੇ 'ਚ ਸੁੱਟ ਦਿੰਦੇ ਨੇ ਜੇ ਆਪ ਨੂੰ ਚੰਗੀ ਥਾਂ ਸੁੱਟਣਾ ਚਾਹੀਦਾ ਹੈ ਇਹ ਗਲੀ ਮੁਹੱਲੇ 'ਚ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਉਸ ਨਾਲ ਗੰਦਗੀ ਪੈਦਾ ਹੁੰਦੀ ਹੈ ਇਸ ਨਾਲ ਬਿਮਾਰੀਆਂ ਲੱਗਦੀਆਂ ਹਨ ਮੱਛਰ ਪੈਦਾ ਹੁੰਦੇ ਅਤੇ ਇਹ ਇਸ ਕਰਕੇ ਬਿਮਾਰ ਜ਼ਿਆਦਾ ਹੋ ਜਾਂਦੇ ਹਾਂ ਇਹਨੂੰ ਪ੍ਰਦੂਸ਼ਣ ਨੂੰ ਜਲਦ ਤੋਂ ਜਲਦ ਰਫ਼ਾ ਦਫ਼ਾ ਕੀਤਾ ਜਾਵੇ ਅਤੇ ਗਲੀ ਮੁਹੱਲੇ 'ਚ ਕੂੜਾ ਨਾ ਸੁੱਟਿਆ ਜਾਵੇ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸਨੂੰ ਕੂੜਾ ਕਰਕਟ ਵਾਲਿਆਂ ਨੂੰ ਉਸ ਵਿੱਚ ਪਾ ਕੇ ਅ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਆਵਾ ਜਾਵੀ ਪ੍ਰਦੂਸ਼ਣ ਇਹ ਵੀ ਧੁਮਾਂ ਦਾ ਹਾਂ ਇਹ ਵੀ ਘੱਟ ਕੀਤਾ ਜਾਵੇ ਇਹ ਹੀ ਬੇਨਤੀ ਕਰਦੇ ਹਾਂ ਕਿ ਪੰਜਾਬ 'ਚ ਪ੍ਰਦੂਸ਼ਣ ਜ਼ਿਆਦਾ ਪੈਦਾ ਹੋ ਰਿਹਾ ਹੈ ਵਾਤਾਵਰਨ ਬਹੁਤ ਜ਼ਿਆਦਾ ਖ਼ਰਾਬ ਹੋ ਰਿਹਾ ਹੈ ਇਹ ਨੂੰ ਘੱਟ ਤੋਂ ਘੱਟ ਕੰਟਰੋਲ 'ਚ ਕੀਤਾ ਜਾਵੇ ਇਹ ਹੀ ਧੰਨਵਾਦ ਕਰਦੇ ਹਾਂ ਸਾਡੇ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਹ ਸਾਡੀ ਸਿਹਤ ਨੂੰ ਬਹੁਤ ਖ਼ਰਾਬ ਕਰਦਾ ਹੈ ਇਹ ਸਾਡੇ ਸਿਹਤ ਲਈ ਹਾਨੀਕਾਰਕ ਹੈ ਇਸ ਨੂੰ ਰਫ਼ਾ ਦਫ਼ਾ ਕੀਤਾ ਜਾਵੇ ਅਤੇ ਸੁਧਾਰ ਕੀਤਾ ਜਾਵੇ ਇੰਡੀਆ 'ਚ ਅਸੀਂ ਵਿੱਚ ਕਾਫੀ ਕੁਛ ਕੰਮ ਕੀਤਾ ਹੈ ਕੋਸ਼ਿਸ਼ ਪੂਰੀ ਕਰਨੇ ਜਿਤਨਾ ਵੀ ਆਪ ਵੀ ਗੰਦਗੀ ਪੈਦਾ ਹੋਣ ਤੋਂ ਬਚਾ ਰਹੇ ਹਾਂ ਇਸ ਲਈ ਪ੍ਰਦੂਸ਼ਣ ਲਈ ਘੱਟ ਕਰਨ ਲਈ ਬੇਨਤੀ ਸਰਕਾਰ ਨੂੰ ਕਰਦੇ ਹਾਂ ਕੋਈ ਕਾਰਵਾਈ ਕਰੋ ਤੁਸੀਂ ਸਾਡੀ ਬੇਨਤੀ ਸੁਣੋ ਜਿਸ ਨਾਲ ਦੇਸ਼ ਆਪਣਾ ਸੁਧਰੇ ਅਤੇ ਸੰਕਟ ਤੋਂ ਬਚੇ